ਸਤਿ ਸ਼੍ਰੀ ਅਕਾਲ ਜੀ ਤੁਸੀਂ ਵਰਮਾ ਕਿਤਾਬਾਂ ਵਾਲ਼ੀ ਦੁਕਾਨ ਮੋਹਾਲੀ ਤੋਂ ਬੋਲ਼ ਰਹੇ ਹੋ ਮੈਂ ਹਰਿਕ੍ਰਿਸ਼ਨ ਸਕੂਲ ਤੋਂ ਬਲਜਿੰਦਰ ਮੈਡਮ ਬੋਲ਼ ਰਹੀ ਹਾਂ ਮੈਂ ਤੁਹਾਡੀ ਦੁਕਾਨ ਤੋਂ ਆਪਣੇ ਸਕੂਲ ਦੇ ਬੱਚਿਆਂ ਲਈ ਕਿਤਾਬਾਂ ਆਡਰ ਕੀਤੀਆਂ ਸੀ ਇਹ ਮੈਂ ਪਹਿਲੀ ਵਾਰ ਕਿਸੇ ਦੇ ਕਹਿਣ 'ਤੇ ਔਨਲਾਈਨ ਕਿਤਾਬਾਂ ਮੰਗਵਾਈਆਂ ਸੀ ਤੁਹਾਡਾ ਆਡਰ ਮੈਨੂੰ ਨਿਰਧਾਰਿਤ ਸਮੇਂ ਉੱਤੇ ਮਿਲ ਗਿਆ ਅਤੇ ਸਾਰੀ ਪੈਕਿੰਗ ਬਹੁਤ ਵਧੀਆ ਢੰਗ ਨਾਲ ਕੀਤੀ ਹੋਈ ਸੀ ਅਤੇ ਕਿਤਾਬਾਂ ਵੀ ਬੜੀ ਬੜੀ ਵਧੀਆ ਸੀ ਇਨ੍ਹਾਂ ਦੀਆਂ ਜਿਲਤਾਂ ਅਤੇ ਛਪਾਈ ਅੱਖਰ ਬੜੇ ਵਧੀਆ ਢੰਗ ਨਾਲ ਛਪੇ ਹੋਏ ਸੀ ਕਾਪੀ ਕਿਤਾਬਾਂ ਦੇ ਪੇਜ਼ ਬੜੇ ਸੋਹਣੇ ਸੀ ਤਸਵੀਰਾਂ ਰੰਗਦਾਰ ਸੀ ਬੱਚੇ ਬੜੇ ਖੁਸ਼ ਹੋਏ ਅਤੇ ਮੈਂ ਇਹ ਤੁਹਾਡਾ ਧੰਨਵਾਦ ਕਰਨ ਲਈ ਫੋਨ ਕੀਤਾ ਵੀ ਕਿਤਾਬਾਂ ਮੈਨੂੰ ਬਹੁਤ ਪਸੰਦ ਆਈਆਂ ਅੱਗੇ ਨੂੰ ਵੀ ਅਸੀਂ ਤੁਹਾਡੇ ਕੋਲ਼ੋ ਹੀ ਕਿਤਾਬਾਂ ਮੰਗਵਾਂਵਾਗੇ ਅਤੇ ਇਸੀ ਢੰਗ ਨਾਲ ਜਿੱਦਾਂ ਹੁਣ ਇਨ੍ਹਾਂ ਦੀ ਬਾਈਡਿੰਗ ਹੋਈ ਵੀ ਆ ਜਿੱਦਾਂ ਇਨ੍ਹਾਂ ਦੀਆਂ ਜਿਲਦਾਂ ਬੜੀ ਵਧੀਆ ਹੈ ਪੇਜ਼ ਫਟਣ ਦੀ ਵੀ ਕੋਈ ਸੰਭਾਵਨਾ ਵੀ ਨਹੀਂ ਹੁੰਦੀ ਨਹੀਂ ਜਿਲਦਾਂ ਉੱਖੜੀਆਂ ਰਹਿੰਦੀਆਂ ਨੇ ਪਰ ਤੁਹਾਡੀਆਂ ਕਿਤਾਬਾਂ ਮੈਨੂੰ ਬਹੁਤ ਪਸੰਦ ਆਈਆਂ ਬੜੇ ਵਧੀਆ ਢੰਗ ਨਾਲ ਇਹ ਜਿਲਤਾਂ ਹੋਈਆਂ ਵੀਆਂ ਸੀ ਪੇਜ਼ ਬੜੇ ਵਧੀਆ ਸੀ ਅਤੇ ਛਪਾਈ ਅੱਖਰਾਂ ਦੀ ਛਪਾਈ ਬੜੀ ਵਧੀਆ ਸੀ ਧੰਨਵਾਦ